ਹਾਂਜੀ ਪੰਜਾਬੀ ਭਾਸ਼ਾ ਪਹਿਲਾਂ ਨਾਲ਼ੋਂ ਬਹੁਤ ਜ਼ਿਆਦਾ ਵਿਕਸਿਤ ਹੋਈ ਆ ਜਿਵੇਂ ਕਿ ਸੋਸਲ ਮੀਡੀਆ ਦੇ ਰਾਹੀਂ ਅਤੇ ਹੋਰ ਸਕੂਲਾਂ ਵਿੱਚ ਵੀ ਜਿਵੇਂ ਬਹੁਤ ਜ਼ਿਆਦਾ ਅਤੇ ਜਿਵੇਂ ਆਪਣੇ ਨਾਲ਼ ਚੰਡੀਗੜ੍ਹ ਸ਼ਹਿਰ ਆ ਇਸਦੇ ਵਿੱਚ ਜਿੰਨ੍ਹੇ ਵੀ ਸਕੂਲ ਆ ਸਰਕਾਰੀ ਪ੍ਰਾਈਵੇਟ ਸਾਰਿਆਂ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਹੋਈ ਆ ਅਤੇ ਸੋਸਲ ਮੀਡੀਆ ਨਾਲ਼ ਵੀ ਬਹੁਤ ਜ਼ਿਆਦਾ ਫ਼ਰਕ ਪਿਆ ਏ ਏ ਹੋਰ ਸਾਡੇ ਨਾਲ਼ ਜਿਵੇ ਸੋਸਲ ਮੀਡੀਆ ਕਰਕੇ ਬਾਹਰ ਵੀ ਆਪਾਂ ਬਾਹਰ ਦੀਆਂ ਕੰਟਰੀਆਂ ਨਾਲ਼ ਵੀ ਜਿਵੇਂ ਜੁੜੇ ਹਾਂ ਵੱਡੇ ਵੱਡੇ ਦੇਸ਼ਾਂ ਵਿੱਚ ਵੀ ਪੰਜਾਬੀ ਸਕੂਲ ਸਾਨੂੰ ਪਤਾ ਲੱਗਦਾ ਕਿ ਪੜ੍ਹਾ ਰਹੇ ਆ ਅਮਰੀਕਾ ਕਨੇਡਾ ਆਸਟ੍ਰੇਲੀਆ ਇਹਨਾਂ ਵਿੱਚ ਵੀ ਬਹੁਤ ਸਾਰੀ ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਗਈ ਆ ਜਿਵੇਂ ਕਿ ਉੱਥੇ ਸਕੂਲਾਂ ਵਿੱਚ ਵੀ ਪੜ੍ਹਾਈ ਜਾਣ ਲੱਗੀ ਆ ਦੇਸ ਤੋਂ ਬਾਹਰ ਵੀ ਪੰਜਾਬੀ ਭਾਸ਼ਾ ਬਹੁਤ ਜ਼ਿਆਦਾ ਵਿਕਸਿਤ ਹੋ ਰਹੀ ਆ ਅਤੇ ਸਕੂਲਾਂ ਵਿੱਚ ਵੀ ਪੰਜਾਬ ਵਿੱਚ ਤਾਂ ਲਾਜ਼ਮੀ ਹੈ ਹੀ ਆ ਅਤੇ ਚੰਡੀਗੜ੍ਹ ਵਿੱਚ ਵੀ ਹੋ ਗਈ ਆ ਕਈ ਹਰਿਆਣੇ ਦੇ ਸਕੂਲਾਂ ਵਿੱਚ ਵੀ ਪੜ੍ਹਾਈ ਜਾਂਦੀ ਹੈ ਜਿਵੇਂ ਪ੍ਰਾਈਵੇਟ ਸਕੂਲ ਈ ਲਾ ਲਓ ਅਤੇ ਚੰਡੀਗੜ੍ਹ ਤਾਂ ਸਰਕਾਰੀ ਸਕੂਲ ਵਿੱਚ ਵੀ ਪੜ੍ਹਾਈ ਜਾਂਦੀ ਆ ਅਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਵੀ ਸਕੂਲ ਖੁੱਲ੍ਹੇ ਹੋਏ ਆ ਪੰਜਾਬੀ ਸਕੂਲ ਵੀ ਖੁੱਲ੍ਹ ਗਏ ਆ ਕਨੇਡਾ ਵਿੱਚ ਅਮਰੀਕਾ ਵਿੱਚ ਆਸਟ੍ਰੇਲੀਆ ਵਿੱਚ ਸਭ ਜਗ੍ਹਾ ਪੰਜਾਬੀ ਬਹੁਤ ਜ਼ਿਆਦਾ ਪਹਿਲਾਂ ਨਾਲ਼ੋਂ ਵਿਕਸਿਤ ਹੋਈ ਆ